ਹੈਲੋ ਸਤਨਾਮ ਕਿੱਥੇ ਫਿਰਦਾ ਸੀ ਕਿਵੇਂ ਠੀਕ ਹੈ ਤਾਂ ਫਿਰ ਤੂੰ ਪੇਪਰ 'ਚ ਪਹੁੰਚ ਜਾਏਂਗਾ ਟਾਈਮ 'ਤੇ ਠੀਕ ਹੈ ਠੀਕ ਹੈ ਮੈਂ ਤਾਂ ਬਠਿੰਡੇ ਸੀ ਹਜੇ ਤੇ ਯਾਰ ਮੈਂ ਬਠਿੰਡੇ ਖੜੀ ਸੀ ਹਜੇ ਤੇ ਦੋ ਬੱਸਾਂ ਮੇਰੀਆਂ ਟੱਪ ਗਈਆਂ ਅਤੇ ਇੱਕ ਬੱਸ ਮਿਸ ਹੋ ਗਈ ਮੈਨੂੰ ਲੱਗਦਾ ਮੈਂ ਵੀ ਲੇਟ ਹੋ ਜਾਊਂਗੀ ਪੇਪਰ ਤੋਂ ਦਸ ਵੀਹ ਮਿੰਟ ਇਹ ਪੰਗਾ ਹੀ ਬਾਹਲਾ ਪਾ ਰੱਖਿਆ ਬੱਸਾਂ ਵਾਲਿਆਂ ਨੇ ਯਾਰ ਇੱਕ ਬੱਸ ਸੀਗੀ ਉਹ ਫੁੱਲ ਟਿਕਟ ਮੰਗਦੇ ਸੀਗੇ ਪੰਜਾਹ ਰੁਪਏ ਫੁੱਲ ਟਿਕਟ ਦੇ ਪੈਸੇ ਵੀ ਹੈ ਨਹੀਂ ਸੀ ਮੇਰੇ ਕੋਲ ਹਾਂ ਕਰਦੇ ਨਹੀਂ ਨਾ ਇਹ ਸਟੂਡੈਂਟ ਦਾ ਨਾ ਕੋਈ ਪਾਸ ਬਣਾਉਂਦੇ ਆ ਅਤੇ ਸਰਕਾਰੀ ਬੱਸਾਂ 'ਤੇ ਤਾਂ ਬੱਸਾਂ ਦੀ ਵੀ ਬਹੁਤ ਘਾਟ ਆ ਹਾਂ ਘੰਟੇ ਬਾਅਦ ਇੱਕ ਬੱਸ ਜਾਂਦੀ ਆ ਵੀਹ ਵੀਹ ਮਿੰਟਾਂ ਬਾਅਦ ਸਰਵਿਸ ਹੋਣੀ ਚਾਹੀਦੀ ਆ

ਹਾਂ ਮੈਂ ਇੰਨੀ ਗਰਮੀ 'ਚ ਖੜੀ ਹਾਂ ਮੈਂ ਤਾਂ ਧੁੱਪੇ ਪਤਾ ਨਹੀਂ ਪੇਪਰ ਦੇ ਟਾਈਮ 'ਤੇ ਪਹੁੰਚੂਗੀ ਕਿ ਨਹੀਂ ਹੋਰ ਪੰਗਾ ਹੀ ਪਾ ਰੱਖਿਆ ਹੁਣ ਇਹਨਾਂ ਨੇ ਉਧਰੋਂ ਟੀਚਰ ਗਾਲਾਂ ਦਿੰਦੇ ਆ ਕਲਾਸ 'ਚ ਜੇ ਟਾਈਮ ਸਿਰ ਨਹੀਂ ਪਹੁੰਚਦੇ ਹੋਰ ਦੇਖਦੇ ਹਾਂ ਚੱਲ ਫਿਰ ਕੀ ਬਣਦਾ ਬੱਸਾਂ ਵਾਲਿਆਂ ਹਾਂ ਪੜ੍ਹ ਕੇ ਤਾਂ ਆਈ ਹਾਂ ਪਰ ਹੁਣ ਟੈਨਸ਼ਨ ਬੱਸਾਂ ਵਾਲੇ ਨੇ ਸਾਰਾ ਭੁੱਲਾ ਤਾ ਦਿਮਾਗ 'ਚ ਇੱਕ ਗਰਮੀ ਇੰਨੀ ਆ ਬੱਸਾਂ ਨਾਲ ਬਹੁਤ ਦਿੱਕਤ ਆਉਂਦੀ ਆ ਤੇ ਹੋਰ ਭੀੜ ਹੀ ਬਹੁਤ ਹੁੰਦੀ ਹੈ ਪੰਗਾ ਹੀ ਆ ਠੀਕ ਹੈ